ਖਾਣ ਪੀਣ ਦੀਆਂ ਚੀਜ਼ਾਂ ਜਿਸ ਤਰ੍ਹਾਂ ਮੂਲੀ ਗਾਜਰ ਰੋਟੀ ਗੋਭੀ ਸਪਰਾਊਟਸ ਦਾਲਾਂ ਘੀ ਘਿਓ ਦੁੱਧ ਪਨੀਰ ਦਹੀਂ ਮੱਖਣ ਮਿਠਾਈਆਂ ਜਿਸ ਤਰ੍ਹਾਂ ਗੋਭੀ ਗਾਜਰ ਮੂਲੀ ਸ਼ਲਗਮ ਰੋਟੀ ਬਦਾਮ ਕਾਜੂ ਮੇਵੇ ਸੋਗੀ ਘਿਓ